ਪੰਜਾਬ ਵਿੱਚ ਬਹੁਤ ਸਾਰੀਆਂ ਜਗ੍ਹਾ ਇਹੋ ਜਿਹੀਆਂ ਹਨ ਜਿੱਥੇ ਹਰ ਚੀਜ਼ ਹਰ ਚੀਜ਼ ਮਿਲਦੀ ਹੈ ਜਿਵੇਂ ਕਿ ਨੇੜੇ ਹੀ ਚੰਡੀਗੜ੍ਹ ਦੇ ਵਿੱਚ ਇੱਕ ਮਾਲ ਹੈ ਜਿਸ ਦਾ ਨਾਂ ਇਲਾਟਾਂ ਹੈ ਇਸ ਵਿੱਚ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਅਤੇ ਹਰ ਤਰ੍ਹਾਂ ਦਾ ਮੰਨੋਰੰਜਨ ਵੀ ਹੁੰਦਾ ਹੈ ਜਿਵੇਂ ਕਿ ਇੱਥੇ ਲੋਕ ਆਪਣੀ ਨਿੱਜੀ ਵਰਤੋਂ ਦੀਆਂ ਚੀਜ਼ਾਂ ਵੀ ਖਰੀਦ ਸਕਦੇ ਹਨ ਅਤੇ ਖਾਣਾ ਪਾਣੀ ਵੀ ਖਾ ਸਕਦੇ ਹਨ ਕੁਝ ਕੁਝ ਅਲੱਗ ਵੀ ਖਾ ਸਕਦੇ ਹਨ ਜਿਵੇਂ ਕਿ ਬਜ਼ਾਰੀ ਬਜ਼ਾਰੀ ਆਈਟਮਾਂ ਖਾਣ ਦੀਆਂ ਆਈਟਮਾਂ ਅਤੇ ਹੋਰ ਬਹੁਤ ਕੁਝ ਅਤੇ ਇਸ ਵਿੱਚ ਇੱਕ ਛੋਟਾ ਸਿਨੇਮਾ ਥੀਏਟਰ ਬਹੁਤ ਇੱਕ ਦੋ ਛੋਟੇ ਸਿਨੇਮਾ ਥੀਏਟਰ ਵੀ ਹਨ ਜਿਸ ਵਿੱਚ ਨਵੀਆਂ ਨਵੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਵੱਡਾ ਮਾਲ ਹੋਣ ਕਰਕੇ ਇਨ੍ਹਾਂ ਦੀਆਂ ਟਿਕਟਾਂ ਵੀ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਖਾਣ ਪੀਣ ਦੀਆਂ ਆਈਟਮਾਂ ਦਾ ਖਰਚਾ ਵੀ ਵੱਧ ਹੁੰਦਾ ਹੈ ਇਸ ਲਈ ਲੋਕ ਇੱਥੇ ਘੱਟ ਹੀ ਜਾਣਾ ਪਸੰਦ ਕਰਦੇ ਹਨ ਜਾਂਦੇ ਵੀ ਹਨ ਅਤੇ ਅਗਰ ਜਾ ਜੇਕਰ ਜਾਂਦੇ ਵੀ ਹਨ ਤਾਂ ਸਿਰਫ ਘੁੰਮਣ ਲਈ ਹੀ ਜਾਂਦੇ ਹਨ